ਪਹਿਲਾਂ ਤਾਂ ਮੈਨੂੰ ਦੌੜਨ ਦਾ ਬਿਲਕੁਲ ਵੀ ਸ਼ੌਕ ਨਹੀਂ ਸੀ ਪਰ ਮੈਨੂੰ ਘਰ ਦੀ ਜ਼ਰੂਰਤ ਲਈ ਦੌੜਨ ਦਾ ਸ਼ੌਕ ਜ਼ਰੂਰੀ ਹੋ ਗਿਆ ਇਸ ਲਈ ਮੈਂ ਦੌੜਨਾ ਸ਼ੁਰੂ ਕੀਤਾ ਮੈਨੂੰ ਆਪਣੇ ਘਰ ਵਿੱਚ ਬਹੁਤ ਜ਼ਰੂਰਤ ਸੀ ਇਸ ਲਈ ਮੈਂ ਪੁਲਿਸ ਦੀ ਜੋਬ ਵਿੱਚ ਵੀ ਦੌੜਨ ਲਈ ਬਹੁਤ ਜ਼ਰੂਰੀ ਸੀ ਇਸ ਲਈ ਮੈਂ ਦੌੜਨਾ ਹੀ ਆਪਣਾ ਸ਼ੌਕ ਬਣਾ ਲਿਆ ਇਸ ਲਈ ਦੌੜਨਾ ਸਰੀਰ ਅਤੇ ਦਿਮਾਗ ਲਈ ਵੀ ਬਹੁਤ ਜ਼ਰੂਰੀ ਸੀ